ਮੈਂ ਬਾਸਕਟਬਾਲ ਖੇਡਦਾ ਹਾਂ ਬਾਸਕਟਬਾਲ ਸਾਡਾ ਜ਼ਿਲ੍ਹਾ ਮਾਨਸਾ ਹੈ ਮਾਨਸਾ ਦੇ ਵਿੱਚ ਸੈਂਟਰਲ ਪਾਰਕ ਵਿੱਚ ਗਰਾਉਂਡ ਬਣਿਆ ਹੋਇਆ ਹੈ ਜਿੱਥੇ ਸ਼ਾਮ ਨੂੰ ਸਵੇਰੇ ਬਾਸਕਟਬਾਲ ਖੇਡੀ ਜਾਂਦੀ ਹੈ ਅਤੇ ਲੋਕਾਂ ਨੂੰ ਉਸ ਖੇਡ ਨਾਲ ਜੋੜਨ ਦਾ ਮਕਸਦ ਇਹ ਹੈ ਇੱਕ ਤਾਂ ਇਸ ਖੇਡ ਦੇ ਵਿੱਚ ਮੂਮੈਂਟ ਸਰੀਰ ਦੀ ਸਰੀਰ ਦੇ ਵੱਖ ਵੱਖ ਅੰਗਾਂ ਦੀ ਲਚਕ ਦਾ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ ਵੀ ਲਚਕ ਬਹੁਤ ਜ਼ਿਆਦਾ ਵੱਧਦੀ ਹੈ ਸਰੀਰ ਦੇ ਵਿੱਚ ਅਤੇ ਬਹੁਤ ਸਰੀਰ ਦਾ ਜ਼ੋਰ ਲੱਗਦਾ ਹੈ ਪਸੀਨਾ ਨਿਕਲਦਾ ਹੈ ਪਰ ਇਹ ਖੇਡ ਲੰਮਾ ਟਾਈਮ ਪੱਕੇ ਫਰਸ 'ਤੇ ਨਹੀਂ ਖੇਡਣੀ ਚਾਹੀਦੀ ਕਿਉਂਕਿ ਲੰਮਾ ਟਾਈਮ ਪੱਕੇ ਫਰਸ਼ ਦੇ ਉੱਪਰ ਇਹ ਖੇਡ ਖੇਡਣ ਨਾਲ ਗੋਡੇ ਖਰਾਬ ਹੋ ਜਾਂਦੇ ਹਨ ਵੈਸੇ ਇਹ ਫੋਰਨ ਦੀ ਖੇਡ ਹੈ ਬਾਹਰਲੇ ਮੁਲਕਾਂ ਦੀ ਖੇਡ ਹੈ ਜਿੱਥੇ ਲੱਕੜ ਦੇ ਗਰਾਊਂਡ ਨੇ ਲੱਕੜ ਦੇ ਮੈਦਾਨ ਨੇ ਉਹਨਾਂ ਮੈਦਾਨਾਂ 'ਤੇ ਗੋਡੇ ਖਰਾਬ ਨਹੀਂ ਹੁੰਦੇ ਅਸੀਂ ਇਹ ਖੇਡ ਨੂੰ ਸੈਂਟਰਲ ਪਾਰਕ ਵਿਖੇ ਹੋਰ ਪਲੇਅਰ ਪਿੰਡਾਂ 'ਚੋਂ ਕਈ ਪਿੰਡਾਂ ਦੇ ਵਿੱਚੋਂ ਜਿਵੇਂ ਜਵਾਰਕੇ ਤੋਂ ਹੋਰ ਖਿਲਣ ਤੋਂ ਪਲੇਅਰ ਆਉਂਦੇ ਹਨ ਉਹਨਾਂ ਨਾਲ ਖੇਡਦੇ ਹਾਂ ਮੈਂ ਹੋਰ ਵੀ ਲੋਕਾਂ ਨੂੰ ਇਹ ਖੇਡ ਖੇਡਣ ਲਈ ਪ੍ਰੇਰਿਤ ਕਰਦਾ ਹਾਂ ਇਸ ਨਾਲ ਸਰੀਰ ਦੀ ਤੰਦਰੁਸਤੀ ਦੇਹ ਅਰੋਗਤਾ ਬਣੀ ਰਹਿੰਦੀ ਹੈ